ਭਾਰਤ ਵਿੱਚ ਲੋਕ ਵੱਖ ਵੱਖ ਧਾਰਮਿਕ ਸਥਾਨਾਂ ਉੱਤੇ ਜਾਂਦੇ ਹਨ ਇੱਥੇ ਹਿੰਦੂ ਮੁਸਲਿਮ ਸਿੱਖ ਭਾਈਚਾਰੇ ਅਤੇ ਕ੍ਰਿਸ਼ਚਨ ਭਾਈਚਾਰਾ ਵੀ ਵੱਸਦਾ ਹੈ ਇਸ ਕਰਕੇ ਲੋਕ ਮੰਦਰ ਗੁਰਦੁਆਰਿਆਂ ਚਰਚਾਂ ਅਤੇ ਮ ਮਸੀਤ ਵੀ ਜਿਹੜੇ ਜਾਂਦੇ ਹਨ ਅਤੇ ਇਸ ਕਰਕੇ ਜ਼ਿਆਦਾਤਰ ਪੰਜਾਬ ਦੇ ਵਿੱਚ ਸਿੱਖ ਧਰਮ ਨਾਲ ਬਿਲੋਂਗ ਕਰਦੇ ਲੋਕ ਰਹਿੰਦੇ ਹਨ ਜਿਸ ਤਰ੍ਹਾਂ ਜੇ ਅਸੀਂ ਆਪਣੀ ਗੱਲ ਕਰ ਲਈਏ ਤਾਂ ਸਿੱਖ ਧਰਮ ਨਾਲ ਬਿਲੋਂਗ ਹੋਣ ਕਰਕੇ ਗੁਰਦੁਆਰੇ ਜ਼ ਜ਼ਿਆਦਾ ਜਾਂਦੇ ਗੁਰਦੁਆਰਿਆਂ ਦੇ ਵਿੱਚ ਵੱਖ ਵੱਖ ਗੁਰੂਆਂ ਦੇ ਜਨਮਦਿਨ ਸ਼ਹੀਦੀ ਪੁਰਬ ਅਤੇ ਅ ਜਿਹੜੇ ਭਾਰਤ ਦੇ ਮੁੱਖ ਤਿਉਹਾਰ ਜਿੱਦਾਂ ਹੋਲੀ ਲੋਹੜੀ ਦੀਵਾਲੀ ਵੀ ਪ੍ਰਮੁੱਖਤਾ ਦੇ ਨਾਲ ਮਨਾਈ ਜਾਂਦੀ ਹੈ ਅਤੇ ਜੇ ਆਪਾਂ ਗੁਰਦੁਆਰਿਆਂ ਦੀ ਗੱਲ ਕਰ ਲਈਏ ਤਾਂ ਵੱਖ ਵੱਖ ਸਮੇਂ ਦੇ ਉੱਤੇ ਜਿਹੜੇ ਧਾਰਮਿਕ ਸਮਾਗਮ ਜਿਹੜੇ ਹੁੰਦੇ ਰਹਿੰਦੇ ਹਨ ਅਤੇ ਜਿਸ ਤਰ੍ਹਾਂ ਗੁਰਪੁਰਬ ਹੋ ਗਏ ਸ਼ਹੀਦੀ ਪੁਰਬ ਹੋ ਗਏ ਅਤੇ ਹੋਰ ਵੀ ਸਮੇਂ ਸਮੇਂ ਉੱਤੇ ਉੱਤੇ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ ਅਤੇ ਏ ਆਪਾਂ ਜਿੱਦਾਂ ਗੱਲ ਕਰ ਲਈਏ ਤਾਂ ਭਾਰਤ ਦੇ ਜਿਹੜੇ ਪ੍ਰਮੁੱਖ ਤਿਉਹਾਰ ਹੈ ਦੀਵਾਲੀ ਹੋਲੀ ਲੋਹੜੀ ਦੀਵਾਲੀ ਤਾਂ ਇਹ ਪੰਜਾਬ ਦੇ ਵਿੱਚ ਅਸੀਂ ਲੋਕ ਵੱਡੇ ਪੱਧਰ ਉੱਤੇ ਇਹ ਵੀ ਮਨਾਉਂਦੇ ਹਾਂ ਜੇ ਆਪਾਂ ਗੱਲ ਕਰ ਲਈਏ ਤਾਂ ਜੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਜੰਮੂ ਕਸ਼ਮੀਰ ਜਾਂ ਹਿਮਾਚਲ ਦੇ ਵਿੱਚ ਪੈਂਦੇ ਧਰਮਿਕ ਸਥਾਨਾਂ ਦੇ ਉੱਤੇ ਵੀ ਲੋਕ ਜਾਣਾ ਪਸੰਦ ਕਰਦੇ ਹਨ